ਕੋਵਿਡ ਉੱਨੀ ਦੀ ਮਹਾਂਮਾਰੀ ਨੇ ਸਾਡੇ ਇਲਾਕੇ ਦੇ ਵਿੱਚ ਜਿਹੜਾ ਸੈਰ ਸਪਾਟਾ ਅਤੇ ਯਾਤਰਾ ਹੈਗੀ ਹੈ ਉਹਨੂੰ ਕਾਫੀ ਪ੍ਰਭਾਵਿਤ ਕੀਤਾ ਸੀ ਕੋਵਿਡ ਨਾਈਨਟੀਨ ਦੇ ਵਿੱਚ ਜਿਹੜੇ ਲੋਕ ਸੀ ਉਹ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਸੀ ਉਹਨਾਂ ਨੂੰ ਘਰਾਂ ਤੋਂ ਬਾਹਰ ਜਾਣ ਦੀ ਮਨਾਹੀ ਸੀਗੀ ਜਿਹੜੀ ਪੁਲਿਸ ਸੀ ਉਹ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਚੱਕਰ ਲਗਾਉਂਦੀ ਸੀਗੀ ਜੇ ਕੋਈ ਬਾਹਰ ਉਹਨਾਂ ਨੂੰ ਕੋਈ ਪਰਸਨ ਮਿਲਦਾ ਸੀਗਾ ਤਾਂ ਉਹਨੂੰ ਪਨਿਸ਼ਮੈਂਟ ਦਿੱਤੀ ਜਾਂਦੀ ਸੀ ਕਿਉਂਕਿ ਇਸ ਮਹਾਂਮਾਰੀ ਦੇ ਦੌਰ ਦੇ ਵਿੱਚ ਬਹੁਤ ਹੀ ਸਾਵਧਾਨੀਆਂ ਰੱਖਣ ਦੀ ਲੋੜ ਸੀਗੀ ਮਤਲਬ ਕਿਸੇ ਨੂੰ ਵੀ ਕੋਵਿਡ ਹੋ ਸਕਦਾ ਸੀਗਾ ਤਾਂ ਜਿਹਦੇ ਕਰਕੇ ਜਿਹੜੀ ਪੁਲਿਸ ਹੈਗੀ ਉਹ ਲਗਾਤਾਰ ਲੋਕਾਂ ਨੂੰ ਸਾਵਧਾਨ ਕਰਦੀ ਸੀਗੀ ਤਾਂ ਜਿਹੜੇ ਲੋਕ ਸੀਗੇ ਇਸ ਮਹਾਂਮਾਰੀ ਦੇ ਦੌਰਾਨ ਘਰਾਂ ਤੋਂ ਬਾਹਰ ਜਮਾ ਬਿਲਕੁਲ ਨਹੀਂ ਨਿਕਲ ਸਕਦੇ ਸੀਗੇ ਜਾਂ ਤਾਂ ਆਪਣੇ ਘਰ ਦੀ ਛੱਤ ਦੇ ਉੱਪਰ ਹੀ ਟਹਿਲ ਸਕਦੇ ਸੀਗੇ ਅਤੇ ਲੋਕਾਂ ਨੂੰ ਜਿਹੜਾ ਸਮਾਨ ਸੀਗਾ ਆਪਣੀ ਡੇਲੀ ਰੂਟੀਨ ਦੇ ਵਿੱਚ ਵਰਤਣ ਦੇ ਲਈ ਸਮਾਨ ਵਾਲੇ ਜਿਹੜੇ ਭਾਈ ਸੀ ਉਹ ਪਿੰਡਾਂ ਦੇ ਵਿੱਚ ਆਉਂਦੇ ਸੀਗੇ ਇੱਕ ਦੋ ਦਿਨ ਛੱਡ ਕੇ ਜੋ ਵੀ ਕਿਸੇ ਨੂੰ ਸਮਾਨ ਦੀ ਲੋੜ ਹੁੰਦੀ ਸੀਗੀ ਤਾਂ ਉਹ ਉਹਨਾਂ ਤੋਂ ਕਲੈਕਟ ਕਰ ਲੈਂਦੇ ਸੀਗੇ ਇਸੇ ਦੌਰਾਨ ਜਿਹੜਾ ਇਹ ਕੋਵਿਡ ਮਹਾਂਮਾਰੀ ਕੋਵਿਡ ਨਾਈਨਟੀਨ ਚੱਲਿਆ ਹੈਗਾ ਇਹਨੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈਗਾ ਅਤੇ ਇਸੇ ਤਰੀਕੇ ਦੇ ਨਾਲ ਜਿਹੜੀ ਯਾਤਰਾ ਹੈਗੀ ਅਤੇ ਤ ਸੈਰ ਸਪਾਟਾ ਵੀ ਹੈਗਾ ਇਹਦੇ ਕਰਕੇ ਇਹਦੇ ਵਿੱਚ ਵੀ ਇਹਨਾਂ ਨੇ ਮਤਲਬ ਕੋਵਿਡ ਨਾਈਨਟੀਨ ਦੇ ਦੌਰਾਨ ਲੋਕ ਬਹੁਤ ਪ੍ਰਭਾਵਿਤ ਹੋਏ ਹੈਗੇ ਉਹ ਕਿਤੇ ਆ ਜਾ ਨਹੀਂ ਸਕੇ ਹੈਗੇ ਜੇ ਕਿਸੇ ਨੇ ਕਿਤੇ ਜਾਣਾ ਵੀ ਸੀਗਾ ਕਿਸੇ ਇੰਪੋਰਟੈਂਟ ਕਿਸੇ ਕਾਰਜ ਦੇ ਲਈ ਜਾਂ ਕਿਸੇ ਹੋਸਪਿਟ ਹੋਸਪਿਟਲ 'ਚ ਜਾਣਾ ਸੀਗਾ ਕਿਸੇ ਡੋਕਟਰ ਨੂੰ ਮਿਲਣਾ ਸੀਗਾ ਤਾਂ ਉਹਨਾਂ ਨੂੰ ਜਿਹੜਾ ਨੇੜੇ ਦਾ ਪੁਲਿਸ ਸਟੇਸ਼ਨ ਹੈਗਾ ਉੱਥੋਂ ਦੇ ਜਿਹੜਾ ਪੁਲਿਸ ਔਫਿਸਰ ਨੇ ਉਹਨਾਂ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਸੀ ਜੋ ਪਰਮਿਸ਼ਨ ਦਿੰਦੇ ਸੀਗੇ ਜੇ ਪੁਲਿਸ ਨੂੰ ਲੱਗਦਾ ਸੀਗਾ ਵੀ ਇਹਨਾਂ ਦਾ ਜਾਣਾ ਜ਼ਰੂਰੀ ਹੈਗਾ ਤਾਂ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਸੀ ਨਹੀਂ ਤਾਂ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਸੀਗਾ ਤਾਂ ਇਸੇ ਦੌਰਾਨ ਜਿਹੜਾ ਕੋਵਿਡ ਨਾਈਨਟੀਨ ਆ ਉਹਨੇ ਯਾਤਰਾ ਅਤੇ ਸੈਰ ਸਪਾਟੇ ਨੂੰ ਬਹੁਤ ਪ੍ਰਭਾਵਿਤ ਕੀਤਾ